ਪੰਜਾਬੀ ਵਿੱਚ ਬੜੇ ਸਾਰੇ ਲੇਖਕ ਨੇ ਅੰਮ੍ਰਿਤਾ ਪ੍ਰੀਤਮ ਹੈ ਸ਼ਿਵ ਕੁਮਾਰ ਬਟਾਲਵੀ ਹੈ ਬੁੱਲੇ ਸ਼ਾਹ ਆਇਆ ਅਤੇ ਸਭ ਤੋਂ ਜਿਹੜਾ ਮਨ ਪਸੰਦ ਕਰਦੀ ਹਾਂ ਉਹ ਹੈਗੇ ਬੁੱਲੇ ਸ਼ਾਹ ਅਤੇ ਐ ਸਤਾਰਾਂ ਅਤੇ ਅਠਾਰਾਂ ਸਦੀ ਦੇ ਕਵੀ ਹੈਗੇ ਹਨ ਇਹਨਾਂ ਦੇ ਜਿਹੜੀ ਕਵਿਤਾਵਾਂ ਹੁੰਦੀਆਂ ਹਨ ਉਹ ਇੰਨੀ ਡੂੰਘਾਈ ਵਿੱਚ ਹਰ ਮੀਨਿੰਗ ਕੱਢਿਆ ਜਾਂਦਾ ਹੈ ਅਤੇ ਬਹੁਤ ਵਧੀਆ ਕਵਿਤਾਵਾਂ ਅਤੇ ਪੋਇਟਰੀ ਅਤੇ ਸ਼ਾਇਰੀ ਲਿਖਦੇ ਹਨ ਅਤੇ ਇਹਨਾਂ ਦੇ ਜੋ ਵੀ ਸ਼ਾਇਰੀ ਹੁੰਦੀ ਹੈ ਉਹ ਸਦੀਆਂ ਹੋਣ ਤੱਕ ਇੰਨੀਆਂ ਫੇਮਸ ਹੈ ਕਿ ਹਰ ਇੱਕ ਦੇ ਮੂੰਹ 'ਤੇ ਚੜੀ ਹੁੰਦੀ ਹੈ ਅਤੇ ਬੁੱਲੇ ਸ਼ਾਹ ਜਿਹੜਾ ਹੈਗੇ ਹੈ ਇਨ੍ਹਾਂ ਨੂੰ ਫੇਮਸਲੀ ਬੁੱਲੇ ਸ਼ਾਹ ਵੈਸੇ ਕਾਦਰੀ ਜੀ ਕਹਿੰਦੇ ਹਨ ਅਤੇ ਬਹੁਤ ਫੇਮਸ ਇਹਨਾਂ ਨੂੰ ਸਾਰੇ ਇਹ ਬੁੱਲੇ ਸ਼ਾਹ ਕਹਿ ਕੇ ਬੁਲਾਉਂਦੇ ਹਨ ਅਤੇ ਇਹਨਾਂ ਨੇ ਮੁਗਲ ਏਰਾ ਵਿੱਚ ਮੇਨਲੀ ਲਾਹੌਰ ਦੇ ਰਹਿਣ ਵਾਲੇ ਹਨ ਅਤੇ ਬਹੁਤ ਵਧੀਆ ਇਹਨਾਂ ਦੇ ਹਰ ਕਵਿਤਾ ਵਿੱਚ ਇੱਕ ਜ਼ਿੰਦਗੀ ਦਾ ਇੱਕ ਮਤਲਬ ਕੱਢਿਆ ਹੁੰਦਾ ਅਤੇ ਸੱਚਾਈ ਦੱਸੀ ਗਈ ਹੈ ਕਿ ਹਰ ਇੱਕ ਸਾਡੇ ਇੱਕ ਪਹਿਲੂ 'ਤੇ ਸਾਨੂੰ ਕੀ ਕੀ ਫੇਸ ਕਰਨਾ ਪੈਂਦਾ ਹੈ ਇਹਨਾਂ ਦੀ ਕਵਿਤਾਵਾਂ ਵਿੱਚ ਹਰ ਲਾਈਨ ਵਿੱਚ ਇੱਕ ਜ਼ਿੰਦਗੀ ਦਾ ਮਤਲਬ ਦਿੱਤਾ ਗਿਆ ਹੁੰਦਾ ਹੈ ਜੇ ਆਪਾਂ ਉਹਨਾਂ ਨੂੰ ਧਿਆਨ ਨਾਲ ਪੜ੍ਹੀਏ ਤਾਂ ਬਹੁਤ ਵਧੀਆ ਸ਼ਾਇਰੀ ਲਿਖਦੇ ਸੀ ਅਤੇ ਬਹੁਤ ਜ਼ਿਆਦਾ ਹੀ ਫੇਮਸ ਅਤੇ ਮੇਰੀ ਸਭ ਤੋਂ ਜ਼ਿਆਦਾ ਕਹਿ ਲਓ ਫੇਵਰੇਟ ਇਹਨਾਂ ਦੀ ਸ਼ਾਇਰੀ ਰਹੀ ਹੈ ਬੁੱਲੇ ਸ਼ਾਹ ਜੀ ਦੀ